ਹੈਲੋ ਹੈਲੋ ਮੈਮ ਅਲਵਿੰਦਰ ਟੂਰਿਸਟ ਤੋਂ ਬੋਲ ਰਹੇ ਹੋ ਮੈਮ ਸਤਿ ਸ਼੍ਰੀ ਅਕਾਲ ਮੈਮ ਮੈਮ ਸਾਨੂੰ ਨਾ ਵਿੰਟਰ ਵੀਕੇਸ਼ਨ ਹੋ ਰਹੀਆਂ ਨੇ ਮੈਨੂੰ ਅਤੇ ਮੇਰੀ ਫੈਮਲੀ ਨੂੰ ਅਤੇ ਅਸੀਂ ਨਾ ਕਿਤੇ ਜਾਣਾ ਚਾਹੁੰਦੇ ਹਾਂ ਵੰਨ ਵੀਕ ਦੀ ਵਿੰਟਰ ਵੀਕੇਸ਼ਨ ਹੈ ਅਤੇ ਤੁਸੀਂ ਮੈਨੂੰ ਥੋੜ੍ਹੀ ਜੀ ਇਸ ਬਾਰੇ ਜਾਣਕਾਰੀ ਦੇ ਸਕਦੇ ਹੋ ਅੱਛਾ ਜੀ ਓਕੇ ਮੈਮ ਮੈਮ ਪਰ ਪਰਸਨ ਕਿੰਨੇ ਕੁ ਚਾਰਜਿਸ ਹੋਣਗੇ ਤੁਹਾਡੇ ਓਕੇ ਜੀ ਓਕੇ ਮੈਮ ਠੀਕ ਹੈ ਜੀ ਠੀਕ ਹੈ ਮੈਮ ਅਸੀਂ ਮੈਂ ਨਾ ਵੈਸੇ ਆਪਣੀ ਫੈਮਿਲੀ ਨਾਲ ਜਾਣਾ ਸੋ ਮੈਨੂੰ ਫੈਮਲੀ ਨਾਲ ਇੱਕ ਵਾਰ ਡਿਸਕਸ ਕਰਨਾ ਪਵੇਗਾ ਅਤੇ ਵੈਸੇ ਮੈਨੂੰ ਤੁਹਾਡੇ ਪਲੈਨ ਠੀਕ ਲੱਗੇ ਪਰ ਮੈਂ ਫੈਮਲੀ ਨਾਲ ਡਿਸਕਸ ਕਰਕੇ ਤੁਹਾਨੂੰ ਦੱਸ ਦਾਂਗੀ ਸਾਰਾ ਅਤੇ ਕਿਹੜੀ ਜਗ੍ਹਾ ਅਸੀਂ ਜਾਣਾ ਇਹ ਵੀ ਦੱਸ ਦਾਂਗੇ ਸਾਰੀ ਇਨਫੋਰਮੇਸ਼ਨ ਮੈਂ ਵਟਸਐਪ ਕਰ ਦਾਂਗੀ ਅਤੇ ਮੇਰੇ ਕੋਲ ਤੁਹਾਡਾ ਵਟਸਐਪ ਨੰਬਰ ਹੈ ਓਕੇ ਮੈਮ ਠੀਕ ਹੈ ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ ਮੈਮ